ਹੈਲੋ ਹਾਂਜੀ ਟਰਾਂਸਪੋਰਟ ਏਜੰਸੀ ਤੋਂ ਬੋਲ ਰਹੇ ਹੋ ਮੈਂ ਇੱਕ ਕੈਬ ਬੁੱਕ ਕੀਤੀ ਸੀ ਜਿਹਦਾ ਨੰਬਰ ਹੈ ਪੀ ਵੀ ਚੌਂਤੀ ਬੀ ਬਾਰ੍ਹਾਂ ਛੱਬੀ ਇਸ ਜਿਹੜੀ ਕੈਬ ਹੈ ਇਸਦੀ ਮੈਂ ਸ਼ਿਕਾਇਤ ਦਰਜ ਕਰਵਾਉਣੀ ਸੀਗੀ ਮੈਂ ਕੈਬ ਬੁੱਕ ਕਰਵਾਈ ਸੀਗੀ ਅੱਧੇ ਘੰਟੇ ਦਾ ਰਸਤਾ ਸੀਗਾ ਅਤੇ ਉਹਦੇ ਲਈ ਜਿਹੜਾ ਤੁਹਾਡਾ ਡਰਾਇਵਰ ਹੈ ਕੈਬ ਦਾ ਉਹਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਕੋਵਿਡ ਚੱਲ ਰਿਹਾ ਗਾ ਉਹਦੀ ਇੰਸਟਰਕਸ਼ਨਸ ਫੋਲੋ ਨਹੀਂ ਕੀਤੀਆਂ ਸੀ ਮਾਸਕ ਨਹੀਂ ਪਾਇਆ ਹੋਇਆ ਸੀਗਾ ਜਿਹੜੀ ਉਹਦੀ ਕੈਬ ਸੀਗੀ ਉਹ ਪੂਰੀ ਗੰਦੀ ਸੀਗੀ ਉਹਦਾ ਵਿਵਹਾਰ ਨਹੀਂ ਚੰਗਾ ਸੀਗਾ ਕੈਬ ਨੂੰ ਸਾਫ਼ ਨਹੀਂ ਕੀਤਾ ਹੋਇਆ ਸੀਗਾ ਜਿਹੜੀ ਉਹਦੀ ਸ਼ੀਟਾਂ ਸੀ ਉਹ ਗੰਦੀਆਂ ਸੀਗੀਆਂ ਅਤੇ ਉੱਪਰ ਦੀ ਜਿਹੜਾ ਉਹਨਾਂ ਦਾ ਬਿਹੇਵੀਅਰ ਸੀਗਾ ਬਿਲਕੁਲ ਠੀਕ ਨਹੀਂ ਹੈਗਾ ਸੀਗਾ ਮਤਲਬ ਉਹ ਬਹੁਤ ਗੰਦਾ ਵਿਵਹਾਰ ਕਰ ਰਹੇ ਸੀਗੇ ਤਾਂ ਇਸ ਨੂੰ ਲੈ ਕੇ ਮੈਂ ਜਿਹੜਾ ਤੁਹਾਡਾ ਡਰਾਇਵਰ ਸੀਗਾ ਉਹਦੀ ਸ਼ਿਕਾਇਤ ਦਰਜ ਕਰਵਾਉਣੀ ਹੈਗੀ ਕਿਰਪਾ ਕਰਕੇ ਪਹਿਲਾਂ ਤਾਂ ਮੇਰੀ ਤੁਸੀਂ ਸ਼ਿਕਾਇਤ ਦਰਜ ਕੀਤੀ ਜਾਵੇ ਦੂਜਾ ਉਹਨਾਂ ਨੂੰ ਕੋਵਿਡ ਦੀਆਂ ਇੰਸਟਰਕਸ਼ਨਸ ਫੋਲੋ ਕਰਨ ਦੇ ਲਈ ਕਿਹਾ ਜਾਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਦੋਂ ਕੋਵਿਡ ਚੱਲ ਰਿਹਾ ਗਾ ਤਾਂ ਸਫ਼ਾਈ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਤਾਂ ਤੁਹਾਨੂੰ ਕਿਰਪਾ ਕਰਕੇ ਅਪੀਲ ਆ ਵੀ ਵੀ ਇੱਕ ਤਾਂ ਮੇਰੀ ਸ਼ਿਕਾਇਤ ਦਰਜ ਕਰੋ ਦੂਜਾ ਉਹਨਾਂ ਨੂੰ ਜਿਹੜੇ ਇੰਸਟਰਕਸ਼ਨਸ ਨੇ ਉਹ ਫੋਲੋ ਕਰਨ ਲਈ ਤੁਸੀਂ ਉਹਨਾਂ ਨੂੰ ਕਹੋ ਧੰਨਵਾਦ